ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਿਵੇਂ ਕਿ ਅੱਜ ਕੱਲ੍ਹ ਹਰ ਇੱਕ ਬੱਚਾ ਟਿਊਸ਼ਨ ਜੋਇਨ ਕਰਦਾ ਹੈ ਸਕੂਲ ਤੋਂ ਬਾਅਦ ਤਾਂ ਕਿ ਉਹਦੇ 'ਤੇ ਇੱਕ ਸਪੈਸ਼ਲ ਟਾਈਮ ਲਾ ਕੇ ਇੱਕ ਸੈਪਰੇਟ ਟਾਈਮ ਲਾ ਕੇ ਟੀਚਰ ਉਹਦੇ 'ਤੇ ਜ਼ੋਰ ਦੇ ਸਕੇ ਜ਼ਿਆਦਾ ਅਤੇ ਉਹਦੀ ਇਮਪਰੂਵ ਕਰ ਸਕੇ ਉਹਦੀ ਸਟੱਡੀਜ਼ ਨੂੰ ਉਹਦੀ ਸਕਿੱਲਸ ਨੂੰ ਹੋਰ ਇਮਪਰੂਵ ਕਰ ਸਕੇ ਤਾਂ ਕਿ ਬੱਚਾ ਵਧੀਆ ਤੋਂ ਵਧੀਆ ਪੜ੍ਹ ਸਕੇ ਅਤੇ ਆਪਣਾ ਬੈਸਟ ਦੇ ਸਕੇ ਆਪਣੇ ਅੱਛੇ ਨੰਬਰ ਪ੍ਰਾਪਤ ਕਰ ਸਕੇ ਅਤੇ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰ ਸਕੇ ਟਿਊਸ਼ਨਸ 'ਤੇ ਇਹ ਸਿਸਟਮ ਹੁੰਦਾ ਹੈ ਕਿ ਜਿਵੇਂ ਸ਼ਾਮ ਨੂੰ ਬੰਦਾ ਫਰੀ ਵੀ ਹੁੰਦਾ ਆ ਮੈਂ ਖ਼ੁਦ ਟਿਊਸ਼ਨਸ ਦਿੰਦੀ ਹਾਂ ਤੋਂ ਬਾਅਦ ਸਕੂਲ ਟੀਚਿੰਗ ਤੋਂ ਬਾਅਦ ਮੈਂ ਖ਼ੁਦ ਟਿਊਸ਼ਨਸ ਦਿੰਦੀ ਹਾਂ ਬੱਚਿਆਂ ਨੂੰ ਅਤੇ ਮੇਰੇ ਕੋਲ ਬੱਚੇ ਆਉਂਦੇ ਨੇ ਛੋਟੇ ਛੋਟੇ ਪੜ੍ਹਨ ਲਈ ਇਹਦੇ ਨਾਲ ਮੇਰਾ ਵੀ ਖ਼ੁਦ ਦਾ ਸ਼ਾਮ ਟਾਈਮ ਮੈਂ ਫਰੀ ਹੁੰਦੀ ਹਾਂ ਇਹਦੇ ਨਾਲ ਮੇਰਾ ਥੋੜ੍ਹਾ ਮੈਂ ਬਿਸੀ ਰਹਿੰਦੀ ਹਾਂ ਨਾਲੇ ਨਾਲੇ ਮੈਨੂੰ ਵੀ ਥੋੜ੍ਹਾ ਆਪਣਾ ਟਾਈਮ ਸਪੈਂਡ ਕਰਨ ਨੂੰ ਮਿਲਦਾ ਹੈ ਅਤੇ ਬੱਚਿਆਂ ਨੂੰ ਕੁਛ ਸਿਖਾਉਣ ਨਾਲ ਮੇਰੀ ਵੀ ਸਕਿੱਲਸ ਵੱਧਦੀਆਂ ਨੇ ਮੇਰੇ ਵੀ ਇਮਪਰੂਵਮੈਂਟ ਹੋ ਰਹੀ ਹੈ ਅਤੇ ਉਨ੍ਹਾਂ ਦੀ ਲਾਈਫ਼ 'ਚ ਉਨ੍ਹਾਂ ਦਾ ਵੀ ਸਿਲੇਬਸ ਕਵਰ ਹੋ ਰਿਹਾ ਉਨ੍ਹਾਂ ਦਾ ਵੀ ਅੱਗੋਂ ਫਿਊਚਰ ਸਕਿਓਰ ਹੋ ਰਿਹਾ ਇਹਦੇ ਨਾਲ ਉਨ੍ਹਾਂ ਦੇ ਪੇਰੈਂਟਸ ਵੀ ਬਹੁਤ ਖੁਸ਼ ਹੁੰਦੇ ਨੇ ਜਦੋਂ ਅੱਛੇ ਸਕੋਰ ਕਰਦੇ ਨੇ ਕਹਿੰਦੇ ਨੇ ਕਿ ਹਾਂ ਇਸ ਟੀਚਰ ਨੇ ਪੜ੍ਹਾਇਆ ਸੀ ਇਨ੍ਹਾਂ ਦਾ ਅੱਛਾ ਰਿਸਪੋਨਸ ਆਇਆ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਆ ਕਿ ਅਗਰ ਬੱਚਾ ਸਕੂਲ 'ਚ ਇੰਨੇ ਬੱਚਿਆਂ ਦੇ ਵਿੱਚ ਕੁਛ ਬੱਚੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ 'ਤੇ ਟੀਚਰਸ ਨਹੀਂ ਧਿਆਨ ਦੇ ਪਾਉਂਦੇ ਜਾਂ ਕੁਛ ਸ਼ਰਾਰਤੀ ਹੁੰਦੇ ਨੇ ਸਕੂਲ ਵਿੱਚ ਨਹੀਂ ਪੜ੍ਹ ਪਾਉਂਦੇ ਉਨ੍ਹਾਂ ਨੂੰ ਹੁੰਦਾ ਕਿ ਉਨ੍ਹਾਂ 'ਤੇ ਸੈਪਰੇਟ ਟਾਈਮ ਲਗਾਇਆ ਜਾਵੇ ਤਾਂ ਕਿ ਉਹ ਅੱਛਾ ਪੜ੍ਹ ਸਕਣ ਅੱਛਾ ਆਪਣਾ ਦੇ ਸਕਣ ਅਤੇ ਇਸ ਕਰਕੇ ਟਿਊਸ਼ਨਸ ਬੈਸਟ ਹੁੰਦੀਆਂ ਨੇ ਅੱਛੀਆਂ ਹੁੰਦੀਆਂ ਨੇ ਬੱਚਿਆਂ ਲਈ